ਹੈਲੋ ਸ਼ਤਿ ਸ਼੍ਰੀ ਅਕਾਲ ਤੁਹਾਨੂੰ ਬਸ ਮੈਂ ਇਹ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਇੰਨਾ ਬੁਰਾ ਹਾਲ ਹੋਇਆ ਪਿਆ ਹੈਗਾ ਕਿ ਨੌਕਰੀ ਤਾਂ ਦਿੰਦੇ ਨਹੀਂ ਹੈਗੇ ਜੇ ਵੀ ਨਿਕਲਦੀਆਂ ਵੀ ਨੌਕਰੀਆਂ ਤਾਂ ਵੀ ਕੋਈ ਪੋਸਟ ਨਾ ਭਰਦੇ ਹੈਗੇ ਪੇਪਰ ਵੀ ਦੇ ਆਉਂਦੇ ਹੈਗੇ ਕੋਈ ਨੌਕਰੀਆਂ 'ਤੇ ਰੱਖਦਾ ਨਹੀਂ ਹੈਗਾ ਜਿਸ ਕਾਰਨ ਕਿ ਜਿਹੜੇ ਪੰਜਾਬ ਭਾਰਤ ਦੇ ਵਿੱਚ ਹੈਗਾ ਬਹੁਤ ਬੁਰਾ ਹਾਲ ਹੋਇਆ ਪਿਆ ਹੈਗਾ ਬਿਨਾਂ ਨੌਕਰੀਆਂ ਤੋਂ ਨੌਜਵਾਨ ਜਿਹੜੇ ਪੜ੍ਹੇ ਲਿਖੇ ਹੈਗੇ ਵਧੀਆ ਕੁਆ ਕੁਆਲੀਫਿਕੇਸ਼ਨ ਹੈਗੀ ਹੈਗੇ ਉਹਨਾਂ ਵਾਸਤੇ ਤਾਂ ਨਾ ਨੌਕਰੀਆਂ ਬੁਰਾ ਹਾਲ ਹੀ ਹੈਗਾ ਨੌਕਰੀ ਮਿਲਦੀ ਨਹੀਂ ਉਹਨਾਂ ਨੂੰ ਜੇ ਵਧੀਆ ਨੌਕਰੀਆਂ ਕਰਦੇ ਹੈਗੇ ਤਾਂ ਫਿਰ ਉਹ ਸਰਕਾਰ ਨਹੀਂ ਰੱਖਦੀ ਹੈਗੀ ਜਿਹੜੇ ਅਮੀਰ ਲੋਕ ਹੈਗੇ ਉਹ ਸਿਫਾਰਿਸ਼ਾਂ ਰਾਹੀ ਰੱਖੇ ਜਾਂਦੇ ਹੈਗੇ ਉਹ ਸਿਫਾਰਿਸ਼ਾਂ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ ਹੈਗਾ ਅਤੇ ਜਿਹੜੇ ਵਿਚਾਰੇ ਗਰੀਬ ਹੈਗੇ ਉਹ ਐਵੇਂ ਰਹਿ ਜਾਂਦੇ ਹੈਗੇ ਉਹ ਫਿਰ ਨਸ਼ਿਆਂ 'ਤੇ ਲੱਗ ਜਾਂਦੇ ਹੈਗੇ ਫਿਰ ਨਸ਼ਿਆਂ ਕਰਕੇ ਫਿਰ ਆਬਾਦੀ 'ਚ ਫਰਕ ਪੈਂਦਾ ਹੈਗਾ ਸਮਾਜ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈਗਾ ਅਤੇ ਜਿਸ ਕਾਰਨ ਕਿ ਜਿਹੜੀ ਜਨਸੰਖਿਆ ਹੈਗੀ ਘਟਦੀ ਜਾ ਰਹੀ ਹੈਗੀ ਅਤੇ ਨੌਜਵਾਨਾਂ ਦੀ ਜਿਹੜੀ ਸੰਖਿਆ ਜੋ ਘਟਦੀ ਜਾ ਰਹੀ ਆ ਬੁਢਾਪਾ ਬੁਢਾਪੇ ਦੀ ਅਨਪੜ੍ਹਤਾ ਦੀ ਜ਼ਿਆਦਾ ਸੰਖਿਆ ਹੋ ਰਹੀ ਹੈਗੀ ਅਤੇ ਜਿਸ ਕਾਰਨ ਵੀ ਨੌਕਰੀਆਂ ਦਿੱਤੀਆਂ ਨਹੀਂ ਜਾਂਦੀਆਂ ਸਰਕਾਰ ਨੂੰ ਜਿਹੜੇ ਅਮੀਰ ਲੋਕ ਹੈਗੇ ਉਹ ਤਾਂ ਸਿਫਾਰਿਸ਼ ਪਾ ਕੇ ਲੈ ਹੀ ਲੈਂਦੇ ਆ ਜਿਹੜੇ ਵਿਚਾਰੇ ਗਰੀਬ ਰਹਿ ਗਏ ਉਹਨਾਂ ਤੋਂ ਨੌਕਰੀਆਂ ਦਿੰਦੇ ਦਿੰਦੇ ਨਹੀਂ ਹੈਗੇ ਫਿਰ ਜਿਹੜੇ ਹਿਸਾਬ ਨਾਲ ਕਿ ਨਸ਼ਿਆਂ 'ਤੇ ਲੱਗ ਜਾਂਦੇ ਹੈਗੇ ਬਸ ਫਿਰ ਸਰਕਾਰ ਨੂੰ ਇਹੀ ਅਪੀਲ ਹੈਗੀ ਕਿ ਉਹ ਨੌਕਰੀਆਂ ਵੱਲ ਧਿਆਨ ਦੇਣ ਵੀ ਨੌਕਰੀਆਂ ਦੇਣ ਨੌਜਵਾਨਾਂ ਨੂੰ ਜਿਹੜੇ ਪੜ੍ਹੇ ਲਿਖੇ ਨੌਜਵਾਨ ਫਿਰ ਉਹ ਆਦ ਚੈਨਲ ਚਲਾਉਂਦੇ ਹਨ ਯੂਟਿਊਬ ਇੰਸਟਾ ਵਗੈਰਾ ਚਲਾ ਕੇ ਉਹ ਆਪਦੀ ਰੀਲ ਚਲਾਉਂਦੇ ਹਨ ਅਤੇ ਫਿਰ ਰੀਲਾਂ ਤੋਂ ਹੀ ਉਹ ਆਪਦੇ ਪੈਸੇ ਕਮਾਉਂਦੇ ਹਨ ਮਾਰਕੀਟਿੰਗ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਦਾ ਬਸ ਇਹੀ ਉਪਰਾਲਾ ਮਿਲਦਾ ਹੈਗਾ ਨਹੀਂ ਤਾਂ ਫਿਰ ਉਹ ਐਵੇਂ ਵਿਹਲੇ ਕਈ ਕਈ ਤਾਂ ਨਸ਼ਿਆਂ 'ਤੇ ਲੱਗ ਜਾਂਦੇ ਵਿਹਲੇ ਤਾਂ ਕਰਕੇ ਫਿਰ ਸਰਕਾਰ ਨੂੰ ਇਹੀ ਚੀਜ਼ ਦੀ ਅਪੀਲ ਹੈਗੀ ਕਿ ਉਹ ਨੌਕਰੀਆਂ ਦਿਵਾਉਣ ਦੀ ਕਿਰਪਾਲਤਾ ਕਰਨ ਨੂੰ ਵੀ ਨੌਕਰੀਆਂ ਦਿਵਾਉਣ ਸਾਰਿਆਂ ਨੂੰ